ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਪਟਿਆਲੇ ਤੋਂ ਏ ਸਕੇਅਰ ਮੋਬਾਇਲ ਸ਼ੋਪ ਤੋਂ ਬੋਲ ਰਹੇ ਹੋ ਅੱਛਾ ਅੱਛਾ ਸਰ ਮੈਂ ਨਾ ਐਕਚੁਲੀ ਫੋਨ ਲੈਣਾ ਸੀਗਾ ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਮਾਡਲ ਹੋਣਗੇ ਮੈਨੂੰ ਥੋੜ੍ਹਾ ਦੱਸ ਦਿਉ ਅੱਛਾ ਜੀ ਅਤੇ ਠੀਕ ਹੈ ਠੀਕ ਹੈ ਸਰ ਸਰ ਆਈਫੋਨ ਦਾ ਹੈ ਥੋੜ੍ਹਾ ਜਿਹਾ ਮਤਲਬ ਇੱਕ ਮਤਲਬ ਇ ਮਤਲਬ ਮੈਂ ਦੋ ਫੋਨ ਲੈਣੇ ਆ ਇੱਕ ਆਈਫੋਨ ਤਾਂ ਹੈ ਹੀ ਇੱਕ ਹੋਰ ਵੀ ਲੈਣਾ ਤਾਂ ਤੁਸੀਂ ਮੈਨੂੰ ਥੋੜ੍ਹਾ ਆਈਫੋਨ ਦਾ ਦੱਸ ਦੋਗੇ ਵੀ ਕੀ ਪ੍ਰਾਈਸ ਵਗੈਰਾ ਹੋਏਗੀ ਜਾਂ ਕਿਹੜੇ ਕਿਹੜੇ ਮਾਡਲ ਨੇ ਜਾਂ ਕਿਹੜਾ ਬੈਟਰ ਚੱਲ ਰਿਹਾ ਇਸ ਟਾਈਮ ਚੱਲ ਰਿਹਾ ਹੈ ਨਾ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਅਤੇ ਸਰ ਮਤਲਬ ਇਹਦੀ ਪੇਮੈਂਟ ਵਗੈਰਾ ਤੁਸੀਂ ਕੈਸ਼ ਹੀ ਕਰਵਾਉਂਗੇ ਜਾਂ ਫਿਰ ਉਹ ਥੋੜ੍ਹਾ ਹੋ ਵੀ ਜਾਵੇਗੀ ਕਿਸ਼ਤਾਂ ਵਗੈਰਾ 'ਤੇ ਵੀ ਡਾਊ ਡਾਊਨ ਪੇਮੈਂਟ ਦਾ ਥੋੜ੍ਹਾ ਜਿਹਾ ਦੱਸ ਦਿਉ ਵੀ ਕਿੰਨਾ ਕੁ ਹੋਏਗਾ ਜਾਂ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਹੋਣਗੀਆਂ ਮੇਰਾ ਨਹੀਂ ਹੈ ਮੇਰੇ ਬ੍ਰਦਰ ਦਾ ਹੈ ਜੀ ਹਾਂਜੀ ਹਾਂਜੀ ਮੈਂ ਪਟਿਆਲੇ ਤੋਂ ਹੀ ਹਾਂ ਉਹਦੀ ਡਾਊਨ ਪੇਮੈਂਟਸ ਵਗੈਰਾ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਅਤੇ ਮਤਲਬ ਉਹੀ ਥੋੜ੍ਹੇ ਬਹੁਤੇ ਪਰੂਫ ਵਗੈਰਾ ਲੈ ਕੇ ਮਤਲਬ ਕੱਲ੍ਹ ਹੋ ਜਾਵੇਗਾ ਕਿੰਨੇ ਟਾਈਮ ਤੱਕ ਸ਼ੋਪ ਤੁਹਾਡੀ ਖੁੱਲ੍ਹੀ ਰਹੇਗੀ ਨੌ ਕੁ ਵਜੇ ਤੱਕ ਠੀਕ ਠੀਕ ਹੈ ਠੀਕ ਹੈ ਸਰ ਤਾਂ ਮਤਲਬ ਇੱਕ ਆਈਫੋਨ ਦਾ ਤਾਂ ਕਲੀਅਰ ਹੀ ਹੈ ਬਾਕੀ ਓਪੋ ਅਤੇ ਵੀਵੋ 'ਚ ਥੋੜ੍ਹਾ ਜਿਹਾ ਮੈਂ ਦੇਖ ਲਵਾਂਗੀ ਸ਼ਾਇਦ ਉਹ ਵੀ ਮੈਂ ਮਤਲਬ ਮੇਰੇ ਕਜ਼ਨ ਨੇ ਲੈਣਾ ਮੈਂ ਆਈਫੋਨ ਲੈਣਾ ਹੈ ਤਾਂ ਉਹ ਫਿਰ ਮੈਂ ਕੱਲ੍ਹ ਹੀ ਤੁਹਾਨੂੰ ਕੋਲ ਦੇਖ ਲਵਾਂਗੇ ਨਾਲੇ ਤੁਹਾਨੂੰ ਦੱਸ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਸਰ ਮੇਨ ਬਾਜ਼ਾਰ ਦੀ ਹੈ ਨਾ ਲੀਲਾ ਭਵਨ ਦਾ ਹੀ ਜਿਹੜਾ ਤੁਹਾਡਾ ਐਡਰੈਸ ਮੈਂ ਔਨਲਾਈਨ ਚੈੱਕ ਕਰਕੇ ਤੁਹਾਨੂੰ ਕਾਲ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਸਰ ਕੋਈ ਗੱਲ ਨਹੀਂ ਕੱਲ੍ਹ ਫਿਰ ਮੈਂ ਤੁਹਾਨੂੰ ਵਿਜਿਟ ਕਰ ਓਕੇ ਸਰ ਥੈਂਕ ਯੂ